ਹਾਂਜੀ ਸੁਨੀਲ ਕੁਮਾਰ ਕੱਲ੍ਹ ਫੋਨ ਆਇਆ ਸੀ ਤੇਰਾ ਅਤੇ ਤੂੰ ਕੁਛ ਲੋਨ ਬਾਰੇ ਗੱਲ ਕਰ ਰਿਹਾ ਸੀ ਮੇਰੇ ਨਾਲ ਤੈਨੂੰ ਮੇਰੇ ਆਧਾਰ ਕਾਰਡ ਦੀ ਕਾਪੀ ਚਾਹੀਦੀ ਸੀਗੀ ਹਾਰਡ ਕੋਪੀ ਪੈਨ ਕਾਰਡ ਕਾਪੀ ਪਰ ਯਾਰ ਉਹ ਡੀ ਜੀ ਲੋਕਰ 'ਚ ਪਈ ਹੈ ਮੇਰੇ ਕੋਲ ਜੇ ਤੈਨੂੰ ਠੀਕ ਲੱਗੇ ਤਾਂ ਵਟਸਐਪ 'ਤੇ ਮੈਂ ਤੈਨੂੰ ਕਰ ਦਿੰਦਾ ਸੋਫਟ ਕਾਪੀ ਸੈਂਡ ਜੇ ਫਰੀ ਹੈਗਾ ਤਾਂ ਹੁਣ ਦੱਸਦੇ ਮੈਨੂੰ ਮੈਂ ਹੁਣੇ ਭੇਜ ਦਿੰਦਾ ਤੈਨੂੰ ਨਹੀਂ ਤਾਂ ਮੈਂ ਹੁਣ ਨਾ ਸਕੂਲੇ ਹੈਗਾ ਹੁਣ ਸਕੂਲੋਂ ਆ ਕੇ ਅਤੇ ਸ਼ਾਮ ਨੂੰ ਤੈਨੂੰ ਦੇ ਦਿਆਂਗਾ ਜੇ ਜ਼ਿਆਦਾ ਐਮਰਜੈਂਸੀ ਤੈਨੂੰ ਹਾਲੇ ਨਹੀਂ ਹੈਗੀ ਜਿਵੇਂ ਤੈਨੂੰ ਠੀਕ ਲੱਗਦਾ ਮੈਨੂੰ ਦੱਸਦੇ ਜੇ ਕਹੇ ਤਾਂ ਮੈਂ ਹੁਣੇ ਭੇਜ ਦਿੰਦਾ ਬਾਕੀ ਤਿੰਨ ਵਜੇ ਛੁੱਟੀ ਹੁੰਦੀ ਮੈਨੂੰ ਸਕੂਲ ਤੋਂ ਅਤੇ ਮੈਂ ਸਾਢੇ ਕੁ ਤਿੰਨ ਤਾਂ ਘਰ ਪਹੁੰਚ ਜਾਂਦਾ ਅਤੇ ਮੈਂ ਆ ਕੇ ਫਿਰ ਤੇਰਾ ਕੰਮ ਕਰ ਦਿਆਂਗਾ ਠੀਕ ਹੈ ਓਕੇ ਨ